ਹਾਂਜੀ ਵੈਸੇ ਤਾਂ ਸਕੂਲ ਨਵੇਂ ਸ਼ਹਿਰ 'ਤੇ ਬਹੁਤ ਵਧੀਆ ਏ ਆ ਬਹੁਤ ਹੈਗੇ ਆ ਪਰ ਉਹਨਾਂ ਜਿਹੜੇ ਸਰਕਾਰੀ ਸਕੂਲ ਆ ਨਾ ਉਹਨਾਂ ਦੀ ਸਰਕਾਰ ਬਿਲਡਿੰਗਾਂ ਨਹੀਂ ਬਣਾਉਂਦੀ ਜਾਂ ਕੁਝ ਆ ਟੀਚਰ ਵੀ ਵੀ ਵੀ ਐਦੀ ਤਨਖਾਹ ਲੈਂਦੇ ਆ ਜਾਂ ਕੁਝ ਵਾ ਪਰ ਬੱਚਿਆਂ ਦੀ ਪੜ੍ਹਾਈ ਦਾ ਵੀ ਬਹੁਤ ਗਰੀਬ ਬੱਚੇ ਤਾਂ ਪੜ੍ਹਦੇ ਹੀ ਪੜ੍ਹਦੇ ਆ ਜਿਹੜੇ ਅਮੀਰ ਬੱਚੇ ਵੀ ਜਾਣ ਉਥੇ ਸਕੂਲਾਂ 'ਚ ਪੜ੍ਹਨ ਜਾਂ ਕੁਝ ਆ ਤਾਂ ਹੀ ਫਾਇਦਾ ਹੋਵੇ ਵੀ ਸਰਕਾਰ ਨੂੰ ਵ ਚਾਹੀਦਾ ਵਾ ਵੀ ਇੱਦਾਂ ਕੰਮ ਕਰੇ ਬਿਲਡਿੰਗਾਂ ਨੂੰ ਬਣਾਵੇ ਜਾਂ ਕੁਝ ਵਾ ਤਾਂ ਕਰੇ ਤਾਂ ਹੀ ਗੱਲ ਬਣਦੀ ਆ ਅਤੇ ਵੈਸੇ ਸਰਕਾਰੀ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਵਿੱਚ ਵੀ ਅ ਬਹੁਤ ਵਧੀਆ ਵਾ ਬਿਲਡਿੰਗਾਂ ਵੀ ਬਹੁਤ ਵਧੀਆ ਸਭ ਕੁਝ ਬਹੁਤ ਵਧੀਆ ਵਾ ਪਰ ਨਾ ਜਿਹੜੇ ਅ ਉਹਨਾਂ ਪੰਜਾਬੀ ਨਹੀਂ ਉਹਨੂੰ ਦੂਰ ਕਰ ਦਿੰਦੇ ਆ ਪੰਜਾਬੀ ਛੱਡ ਦਿੰਦੇ ਆ ਫਿਰ ਅਸੀਂ ਮਾਤਰ ਭਾਸ਼ਾ ਤੋਂ ਕਿਵੇਂ ਦੂਰ ਹੋਵਾਂਗੇ ਅਤੇ ਸਾਨੂੰ ਇਹੀ ਆ ਸਾਡੀ ਵੀ ਇਹੀ ਆ ਅਸੀਂ ਮਾਤਰ ਭਾਸ਼ਾ ਨਾਲ ਜੁੜੇ ਰਹੀਏ ਅਸੀਂ ਜਿਦਾਂ ਮਾਤਰ ਭਾਸ਼ਾ ਨਾਲ ਬੋਲੀਏ ਸਾਨੂੰ ਉਦਾਂ ਹੀ ਜਿੱਦਾਂ ਅਸੀਂ ਬੱਚਿਆਂ ਨਾਲ ਜਿੱਦਾਂ ਅਸੀਂ ਪੰਜਾਬੀ ਬੋਲਾਂਗੇ ਪੰਜਾਬੀ ਜੀ ਰਵਾਂਗੇ ਬੱਚੇ ਪੰਜਾਬੀ ਸਿੱਖੂਂਗੇ ਇਹੀ ਕੁਝ ਹੁੰਦਾ ਏ ਆ